ਹੈਲੋ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਜੇ ਨਾ ਤੁਸੀਂ ਬੱਚੇ ਨੂੰ ਬਾਹਰ ਭੇਜਣਾ ਫਿਰ ਤਾਂ ਡਿਗਰੀ ਕਰਕੇ ਜਾਵੇ ਕੁਛ ਕਰਕੇ ਜਾਵੇ ਨਾ ਜੇ ਤੁਸੀਂ ਇੰਨਾ ਲੱਖ ਰੁਪਿਆ ਪੱਚੀ ਲੱਖ ਰੁਪਿਆ ਲਗਾ ਹੀ ਰਹੇ ਹੋ ਫਿਰ ਤਾਂ ਤੁਹਾਨੂੰ ਇੰਡੀਆ ਵਿੱਚ ਹੀ ਸੈੱਟ ਕਰਨਾ ਚਾਹੀਦਾ ਹਾਂਜੀ ਹਾਂਜੀ ਹਾਂ ਐਕਚੁਲੀ ਬੱਚੇ ਬੱਚੇ ਕਹਿੰਦ ਸੈਟਿਸਫਾਈਡ ਨਹੀਂ ਹੈ ਇੰਡੀਆ ਵਿੱਚ ਪਹਿਲੀ ਗੱਲ ਕਹਿੰਦੇ ਸਾਨੂੰ ਇੰਨੀ ਨਹੀਂ ਫਾਇਦਾ ਹੋ ਰਿਹਾ ਇੱਥੇ ਕੰਮ ਕਰਨ ਦਾ ਜਾਂ ਕੰਮ ਕਰਨਾ ਹੀ ਚਾਹੁੰਦੇ ਇੱਥੇ ਬਾਹਰ ਜਾ ਕੇ ਵੀ ਬਹੁਤ ਹਾਂ ਹਾਂ ਹਾਂਜੀ ਹਾਂਜੀ ਪਰ ਬੱਚੇ ਇਹ ਹੈ ਕਿ ਮੇਰਾ ਫਰੈਂਡ ਗਿਆ ਅਤੇ ਮੈਂ ਵੀ ਜਾਣਾ ਇੱਕ ਭੇਡ ਚਾਲ ਬਣੀ ਹੋਈ ਹੈ ਕਿ ਮੈਂ ਜਾਣਾ ਹੀ ਜਾਣਾ ਜੋ ਮਰਜੀ ਕਰ ਲਓ ਹੈ ਨਾ ਜੇ ਪੇਰੈਂਟਸ ਕਹਿ ਵੀ ਰਹੇ ਕਿ ਨਹੀਂ ਬੇਟਾ ਅਸੀਂ ਨਹੀਂ ਭੇਜ ਸਕਦੇ ਕਿੱਦਾਂ ਉਹ ਬੱਚੇ ਮ ਪੇਰੈਂਟਸ ਵੀ ਕਹੀ ਜਾ ਰਹੇ ਆ ਪਰ ਬੱਚਾ ਕਹਿੰਦਾ ਨਹੀਂ ਮੈਂ ਤਾਂ ਜਾਣਾ ਹੀ ਬਾਹਰ ਹੈ ਬਿਚਾਰੇ ਪੇਰੈਂਟਸ ਵੇਚ ਵੇਚ ਕੇ ਖੇਤ ਵੇਚ ਵੇਚ ਕੇ ਪੈਸੇ ਇਕੱਠੇ ਕਰ ਕਰ ਕੇ ਭੇਜ ਰਿਹਾ ਉੱਥੇ ਜਾ ਕੇ ਫਿਰ ਧੱਕੇ ਖਾ ਰਹੇ ਬੱਚੇ ਹੈ ਨਾ ਇੱਥੇ ਇੰ ਇੰਡੀ ਹਾਂਜੀ ਹਾਂਜੀ ਜੀ ਜੀ ਜੀ ਜੀ ਬਹੁਤ ਜ਼ਿਆਦਾ ਹੈ ਇਹ ਤਾਂ ਇਹ ਹੀ ਬੱਚੇ ਕੁਝ ਕਰਨਾ ਹੀ ਨਹੀਂ ਚਾਹੁੰਦੇ ਜੇ ਉਹ ਜਦੋਂ ਬੱਚਾ ਏਟ ਨਾਈਟ ਟੈਨਥ ਵਿੱਚ ਪਹੁੰਚਦਾ ਤਾਂ ਉਹ ਬੱਚਾ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੰਦਾ ਕਿ ਮੈਂ ਤਾਂ ਬਾਹਰ ਹੀ ਜਾਣਾ ਮੈਂ ਪੜ੍ਹਨਾ ਹੀ ਨਹੀਂ ਹੈ ਅਤੇ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਕਿ ਬੇਟਾ ਪੜ੍ਹ ਤਾਂ ਲਓ ਟੈਂਨਥ ਤਾਂ ਕਰ ਲਓ ਅਤੇ ਉਹ ਉਸ ਚੱਕਰ 'ਚੋਂ ਪੜ੍ਹਨਾ ਹੀ ਬੰਦ ਕਰ ਦਿੰਦੇ ਆ ਕਿਉਂਕਿ ਬਾਹਰ ਜਾ ਕੇ ਪੜ੍ਹਾਈ ਦਾ ਕੋਈ ਕਹਿੰਦੇ ਫਾਇਦਾ ਹੀ ਕੁਛ ਨਹੀਂ ਉੱਥੇ ਤਾਂ ਟਰੋਲੇ ਹੀ ਚਲਾਉਣੇ ਆ ਜਾਂ ਮਜ਼ਦੂਰੀ ਕਰਨੀ ਹੈ ਉਹਦੇ ਲਈ ਮੈਡਮ ਕਹਿੰਦੇ ਪੜ੍ਹਾਈ ਦੀ ਲੋੜ ਨਹੀਂ ਹੈ ਸਾਨੂੰ ਉਹ ਪੜ੍ਹਨ ਤੋਂ ਵੀ ਬਚਣ ਦੀ ਕੋਸ਼ਿਸ਼ ਕਰਦੇ ਆ ਵੀ ਪੜ੍ਹਨ ਦੀ ਲੋੜ ਹੀ ਕੀ ਆ ਆ ਵੀ ਚੀਜ਼ ਬਹੁਤ ਜ਼ਿਆਦਾ ਜੀ ਜੀ ਜੀ ਹਾਂਜੀ ਹਾਂ

ਫਿਰ ਤਾਂ ਇੰਡੀਆ ਖਾਲੀ ਹੋ ਜੇਗਾ ਪੂਰਾ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਓਕ